ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਕਿੱਥੋਂ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਦੱਸੋ ਜੀ ਅੱਛਾ ਅੱਛਾ ਜੀ ਫਿਰ ਇਹਦੀ ਲਵਾਉਣੀ ਤੁਸੀਂ ਨੇ ਖਬਰ ਜੀ ਲੱਗ ਜਾਊਗੀ ਜੀ ਹਾਂਜੀ ਹਾਂਜੀ ਹਾਂਜੀ ਡੇਂਗੂ ਵੀ ਫੈਲਦਾ ਬਹੁਤ ਬਿਮਾਰੀਆਂ ਹੋ ਜਾਂਦੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਖਬਰ ਬਣਾ ਕੇ ਨਾ ਜੀ ਮੈਂ ਉੱਥੇ ਆ ਜਾਵਾਂਗਾ ਅਤੇ ਤੁਸੀਂ ਮੈਨੂੰ ਖਬਰ ਬਣਾ ਕੇ ਦਿਓ ਅਤੇ ਮੈਂ ਖਬਰ ਲਾਦੂੰਗਾ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕਦੋਂ ਲਵਾਉਣੀ ਤੁਸੀਂ ਦੱਸੋ ਜੀ ਕਦੋਂ ਆਈਏ ਜੀ ਠੀਕ ਹੈ ਠੀਕ ਹੈ ਜੀ ਕੱਲ੍ਹ ਸੁਬਹਾ ਮੈਂ ਸੁਬਹਾ ਅੱਠ ਕੁ ਵਜੇ ਮਿਲਦਾ ਜੀ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਜੀ ਕੋਈ ਗੱਲ ਨਹੀਂ ਓਕੇ ਜੀ ਬਾਏ ਜੀ